ਭਾਰਤ ਵਿੱਚ ਵੱਖ ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ ਅਤੇ ਉਹਨਾਂ ਦਾ ਆਪਣੇ ਆਪਣੇ ਧਰਮਾਂ ਅਤੇ ਰੀਤੀ ਰਿਵਾਜ ਸਭ ਦਾ ਵੱਖੋ ਵੱਖਰਾ ਹੈ